ਸਰਕਾਰ ਨੂੰ ਖੇਡਾਂ ਨੂੰ ਸਾਹਿਤ ਕਰਨ ਲਈ ਪੈਸਾ ਤਾਂ ਖਰਚਦੀ ਹੈ ਅਤੇ ਖਰਚ ਵੀ ਰਹੀ ਹੈ ਪਰ ਜੋ ਪੈਸਾ ਹੈ ਵੋ ਖਿਡਾਰੀਆਂ ਕੋਲ ਨਹੀਂ ਪਹੁੰਚ ਰਿਹਾ ਜੋ ਪੈਸਾ ਹੈ ਉਹ ਜਿਨ੍ਹਾਂ ਦੁਆਰਾ ਭੇਜ ਦਿੱਤਾ ਜਾਂਦਾ ਹੈ ਜਾਂ ਸਰਕਾਰ ਕੁਝ ਐਲਾਨ ਕਰਦੀ ਹੈ ਜੋ ਖਿਡਾਰੀਆਂ ਨੂੰ ਦਿੰਦੀ ਨਹੀਂ ਸਿਰਫ਼ ਐਲਾਨ ਵਿੱਚ ਹੀ ਰਹਿ ਜਾਂਦਾ ਹੈ ਅਤੇ ਕੁਛ ਸਰਕਾਰੀ ਨੌਕਰੀਆਂ ਦਾ ਵੀ ਐਲਾਨ ਕਰਦੀ ਹੈ ਅਤੇ ਉਹ ਸਰਕਾਰੀ ਨੌਕਰੀਆਂ ਵੀ ਜਿਹੜੀਆਂ ਇਹ ਉਹਨਾਂ ਨੂੰ ਨਹੀਂ ਮਿਲਦੀਆਂ ਜਿਸ ਕਰਕੇ ਜੋ ਖੇਡਦੇ ਹਨ ਜੋ ਖਿਡਾਰੀ ਹਨ ਉਹ ਆਪਣੇ ਆਪ ਨੂੰ ਹੋਰ ਉਤਸ਼ਹਿਤ ਨਾ ਕਰਕੇ ਉਹ ਫਿਰ ਖੇਡਾਂ ਵਿੱਚ ਰੁਚੀ ਜੋ ਹੈ ਵੋ ਘਟਾਉਂਦੇ ਜਾ ਰਹੇ ਹਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਹੋਰ ਥਰੂ ਪੈਸੇ ਨਾ ਭੇਜ ਕੇ ਜਾਂ ਜੋ ਐਲਾਨ ਕਰਦੀ ਹੈ ਉਹ ਵੱਧ ਤੋਂ ਵੱਧ ਉਹਨਾਂ ਨੂੰ ਜੋ ਹੈ ਵੋ ਮੁਹੱਈਆ ਕਰਵਾਇਆ ਜਾਣ ਤਾਂ ਕਿ ਜੋ ਹੈ ਵੋ ਖੇਡਾਂ ਵਿੱਚ ਜ਼ਿਆਦਾ ਰੁਚੀ ਰੱਖ ਸਕਣ ਤਾਂ ਕਿ ਉਹ ਆਪਣੇ ਦੇਸ਼ ਦੀ ਸਪੋਰਟਸ ਨੂੰ ਬਹੁਤ ਅੱਗੇ ਤੱਕ ਵਧਾ ਸਕਣ ਜੇਕਰ ਉਹ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਉਹ ਜੋ ਹੈ ਵੋ ਕ ਨਹੀਂ ਖੇਡਦੇ ਕਿਸੇ ਹੋਰ ਕੰਮ ਖੇਤਰ ਵਿੱਚ ਆਪਣੇ ਰੁਜ਼ਗਾਰ ਲਈ ਉਹ ਲੱਗ ਜਾਂਦੇ ਹਨ ਰੁਜ਼ਗਾਰ ਵਿੱਚ ਲੱਗਣ ਕਰਕੇ ਉਹ ਗੇਮਾਂ ਜੋ ਹੈ ਸਾਡੇ ਦੇਸ਼ ਵਿੱਚ ਬਹੁਤ ਹੀ ਜ਼ਿਆਦਾ ਲੋਕਾਂ ਦਾ ਰੁਝਾਨ ਜੋ ਹੈ ਉਸ ਵਿੱਚ ਘਟਦਾ ਜਾ ਰਿਹਾ ਹੈ